ਹੈਲੋ ਹਾਂਜੀ ਨਮਸਤੇ ਮੈਮ ਹਾਂਜੀ ਹਾਂ ਮੈਮ ਤੁਸੀਂ ਕਿੱਥੋਂ ਬੋਲਦੇ ਹੋ ਕੀ ਨਾਮ ਤੁਹਾਡਾ ਅੱਛਾ ਜੀ ਮੈਮ ਮੈਂ ਪੁੱਛਣਾ ਸੀ ਕਿ ਗੁਰਦਾਸਪੁਰ ਦਾ ਪ੍ਰਸਿੱਧ ਤਿਉਹਾਰ ਕਿਹੜਾ ਆ ਇੱਥੇ ਕੀ ਫੇਮਸ ਹੈਗਾ ਵਾ ਗੁਰਦਾਸਪੁਰ 'ਚ ਅੱਛਾ ਜੀ ਠੀਕ ਆ ਅਤੇ ਕੀ ਕੀ ਕਰਦੇ ਆ ਲੋਹੜੀ 'ਤੇ ਹਾਂਜੀ ਠੀਕ ਹੈ ਠੀਕ ਹਾਂਜੀ ਹਾਂਜੀ ਮੈਂ ਮੀਡੀਆ ਤੋਂ ਬੋਲ ਰਹੀ ਹਾਂ ਮੈਂ ਮੈਂ ਮੀਡੀਆ ਤੋਂ ਬੋਲਦੀ ਹਾਂ ਨਾ ਮੈਂ ਪੁੱਛਣਾ ਚਾਹੁੰਦੀ ਕਿ ਗੁਰਦਾਸਪੁਰ ਦਾ ਕਿਹੜਾ ਫੇਮਸ ਤਿਉਹਾਰ ਹੈ ਹਾਂਜੀ ਹਾਂਜੀ ਠੀਕ ਆ ਹੋਰ ਹੋਰ ਕੀ ਕੀ ਬਣਦਾ ਫਿਰ ਹਾਂਜੀ ਹਾਂਜੀ

ਚਲੋ ਠੀਕ ਹੈ ਮੈਮ ਓਕੇ ਥੈਂਕ ਯੂ